ਸਾਡੇ ਸ਼ਹਿਰ ਤੋਂ ਆਵਾਜਾਈ ਲਈ ਦੂਰ ਦਰੇਜ਼ ਦੇ ਸ਼ਹਿਰਾਂ ਵਿੱਚ ਜਾਣ ਵਾਸਤੇ ਸਾਨੂੰ ਦੋ ਦੋ ਵਾਰੀ ਬੱਸਾਂ ਨੂੰ ਬਦਲਣਾ ਪੈਂਦਾ ਹੈ ਅਤੇ ਜੇ ਅਸੀਂ ਸਟੇਸ਼ਨ ਦੇ ਦੁਆਰਾ ਹੀ ਜਾਣਾ ਹੋਵੇ ਟਰੇਨ ਫੜ ਕੇ ਤਾਂ ਵੀ ਸਾਨੂੰ ਸਿੱਧਾ ਹੀ ਟਰੇਨ ਆਪਣੇ ਸ਼ਹਿਰ ਤੋਂ ਨਹੀਂ ਮਿਲਦੀ ਸਾਨੂੰ ਇੱਥੋਂ ਅੰਮ੍ਰਿਤਸਰ ਜਾਣਾ ਪੈਂਦਾ ਹੈ ਜਿਹਦੇ ਜਿਸ ਕਰਕੇ ਸਾਨੂੰ ਥੋੜ੍ਹੀ ਜਿਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ